ਹੈਲੋ ਸਰ ਖੇਡਾਂ ਦੇ ਸਰ ਬੋਲ ਰਹੇ ਹੋ ਸਰ ਮੈਂ ਬਲੱਡੇ ਤੋਂ ਬੋਲ ਰਿਹਾ ਜੀ ਖੇਡਾਂ ਬਾਰੇ ਪੁੱਛਣਾ ਸੀ ਜੀ ਮੈਂ ਕਬੱਡੀ ਬਾਰੇ ਪੁੱਛਣਾ ਸੀ ਮੈਂ ਬਲੱਡੇ ਤੋਂ ਗੱਲ ਰਿਹਾ ਜੀ ਅੱਛਾ ਜੀ ਸਰ ਮੈਂ ਖੇਡਾਂ ਪਹਿਲਾਂ ਵੀ ਖੇਡੀਆਂ ਹੋਈਆਂ ਨੇ ਜੀ ਪਹਿਲਾਂ ਭਿੱਖੀ ਖੇਡੀ ਹੋਈ ਹੈ ਜੀ ਮੈਨੂੰ ਸਰ ਦੇ ਸਰ ਦਾ ਨੇਚਰ ਨਹੀਂ ਵਧੀਆ ਲੱਗਿਆ ਜੀ ਹੋਰ ਵੀ ਬੱਚੇ ਨੇ ਹੋਰ ਵੀ ਬੱਚੇ ਨੇ ਇੱਥੇ ਰਹਿ ਵੀ ਸਕਦੇ ਹਾਂ ਜੇ ਰਹਿਣਾ ਹੋਵੇ ਇੱਥੇ ਰਹਿ ਰਹਿ ਵੀ ਸਕਦੇ ਹਾਂ ਜੇ ਰਹਿਣਾ ਹੋਵੇ ਖਰਚਾ ਕੀ ਆਊਗਾ ਜੀ ਟੀ ਟੀਚਰ ਅਲੱਗ ਅਲੱਗ ਨੇ ਹਾਂਜੀ ਠੀਕ ਹੈ ਸਰ ਮੈਂ ਕੱਲ੍ਹ ਨੂੰ ਦੇਖੂੰਗਾ ਜੀ ਆ ਗਿਆ ਇੰਸਟੀਟਿਊਟ ਦੇ ਗਰਾਉਂਡ ਵਗੈਰਾ ਹੈਗੇ ਨੇ ਠੀਕ ਹੈ ਸਰ ਮੈਂ ਕੱਲ੍ਹ ਨੂੰ ਆਜੂੰ ਜੀ